ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਰਤ ਵਿੱਚ ਚਾਹ ਤਾਂ ਸਾਰੇ ਹੀ ਬੜੇ ਪਸੰਦ ਕਰਦੇ ਨੇ ਲੇਕਿਨ ਮੈਂ ਜਿਹੜੀ ਚਾਹ ਬਣਾਉਂਦੀ ਹਾਂ ਉਹ ਮੈਂ ਬਿਲਕੁਲ ਵਧੀਆ ਤਰੀਕੇ ਨਾਲ਼ ਬਣਾਉਂਦੀ ਹਾਂ ਜਿਹੜੀ ਪੱਤੀ ਜਿਵੇਂ ਕਿ ਤੁਹਾਨੂੰ ਪਤਾ ਅੱਜ ਕੱਲ੍ਹ ਪੱਤੀ ਬਹੁਤ ਮਿਲਾਵਟ ਵਾਲੀ ਆਉਂਦੀ ਹੈ ਮੈਂ ਆਪਣੇ ਘਰ ਦੀ ਵੱਖਰੀ ਵਧੀਆ ਪੱਤੀ ਵਰਤਦੀ ਹਾਂ ਜਿਵੇਂ ਹੁਣ ਜਿਵੇਂ ਕਿ ਦੁੱਧ ਦੁੱਧ ਵੀ ਬਹੁਤ ਮਿਲਾਵਟ ਵਾਲਾ ਆਉਂਦਾ ਹੈ ਆਮ ਦੋਧੀ ਤਾਂ ਦੁੱਧ ਦੇ ਵਿੱਚ ਜਿਵੇਂ ਪਾਊਡਰ ਪਾਉਂਦੇ ਨੇ ਮੈਂ ਉਹ ਦੁੱਧ ਨਹੀਂ ਲੈਣਾ ਪਸੰਦ ਕਰਦੀ ਇਸ ਲਈ ਮੈਂ ਵੱਖਰਾ ਪੈਕਟਾਂ ਵਾਲਾ ਦੁੱਧ ਲਿਆਉਣਾ ਪਸੰਦ ਕਰਦੀ ਹਾਂ ਕਈ ਵਾਰੀ ਤਾਂ ਸਾਡੇ ਪਿੰਡ ਮੱਝਾਂ ਹੈਗੀਆਂ ਨੇ ਅਤੇ ਅਸੀਂ ਉੱਥੋਂ ਚੁਆਵਾਂ ਦੁੱਧ ਮੰਗਵਾ ਲੈਂਦੇ ਹਾਂ ਚਲੋ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਚਾਹ ਕਿਵੇਂ ਬਣਾਉਂਦੀ ਹਾਂ ਮੈਂ ਚਾਹ ਸਭ ਤੋਂ ਪਹਿਲਾਂ ਮੈਂ ਫਰਾਈ ਪੈਨ ਦੇ ਵਿੱਚ ਪਾਣੀ ਪਾਉਂਦੀ ਹਾਂ ਫਿਰ ਮੈਂ ਉਸਨੂੰ ਗੈਸ 'ਤੇ ਧਰਦੀ ਹਾਂ ਫਿਰ ਮੈਂ ਉਸਦੇ ਵਿੱਚ ਥੋੜ੍ਹੀ ਪੱਤੀ ਪਾਉਂਦੀ ਹਾਂ ਪੱਤੀ ਪਾਉਣ ਤੋਂ ਬਾਅਦ ਮੈਂ ਉਸ ਵਿੱਚ ਥੋੜ੍ਹੀ ਖੰਡ ਪਾਉਂਦੀ ਹਾਂ ਫਿਰ ਮੈਂ ਉਹਨੂੰ ਥੋੜ੍ਹਾ ਜਿਹਾ ਰਿੰਨ੍ਹਦੀ ਹਾਂ ਰਿੰਨ੍ਹਣ ਤੋਂ ਬਾਅਦ ਫਿਰ ਮੈਂ ਉਹਦੇ ਵਿੱਚ ਮਸਾਲਾ ਪਾਉਂਦੀ ਹਾਂ ਮਸਾਲਾ ਮੈਂ ਆਪਣੇ ਘਰ ਖੁਦ ਤਿਆਰ ਕਰਦੀ ਹਾਂ ਮੈਂ ਮਸਾਲਾ ਬਹੁਤ ਵਧੀਆ ਤਰੀਕੇ ਨਾਲ਼ ਬਣਾਇਆ ਹੋਇਆ ਹੈ ਆਪਣੇ ਘਰ ਵਿੱਚ ਲੋਂਗ ਮੋਟੀ ਇਲਾਚੀ ਹਰੀ ਇਲਾਚੀ ਏ ਦਾਲਚੀਨੀ ਇਹ ਸਾਰੀਆਂ ਚੀਜ਼ਾਂ ਨੂੰ ਪੀਸ ਕੇ ਮੈਂ ਆਪਣੇ ਘਰ ਵਿੱਚ ਵੱਖਰਾ ਮਸਾਲਾ ਬਣਾਇਆ ਹੋਇਆ ਹੈ ਅਤੇ ਫਿਰ ਮੈਂ ਜਦੋਂ ਮੇਰੀ ਚਾਹ ਰਿੱਝ ਜਾਂਦੀ ਹੈ ਤਾਂ ਮੈਂ ਉਸ ਵਿੱਚ ਦੁੱਧ ਪਾਉਂਦੀ ਹਾਂ ਦੁੱਧ ਪਾਉਣ ਤੋਂ ਬਾਅਦ ਉਸ ਮਸਾਲੇ ਦੀ ਸਮੈਲ ਜਿਹੜੀ ਆ ਬਹੁਤ ਖੁਸ਼ਬੂ ਜਿਹੜੀ ਬਹੁਤ ਵਧੀਆ ਆਉਂਦੀ ਹੈ ਅਤੇ ਉਸ ਖੁਸ਼ਬੂ ਸਾਰਿਆਂ ਨੂੰ ਬੜੀ ਪਸੰਦ ਆਉਂਦੀ ਹੈ ਅਤੇ ਫਿਰ ਮੇਰੀ ਚਾਹ ਬਣ ਜਾਂਦੀ ਹੈ ਅਤੇ ਮੈਂ ਉਸਨੂੰ ਕੱਪਾਂ ਵਿੱਚ ਪਾ ਕੇ ਸਾਰਿਆਂ ਦ ਨੂੰ ਦਿੰਦੀ ਹਾਂ ਅਤੇ ਸਾਰੇ ਮੇਰੇ ਹੱਥ ਦੀ ਚਾਹ ਪੀਣੀ ਬਹੁਤ ਪਸੰਦ ਕਰਦੇ ਨੇ ਧੰਨਵਾਦ